ਮੇਰੇ ਅਨੁਸਾਰ ਪਰਿਵਾਰ ਜਾਂ ਦੋਸਤਾਂ ਨਾਲ ਮਨੋਰੰਜਨ ਕਰਨਾ ਸਭ ਤੋਂ ਵਧੀਆ ਗੱਲ ਹੈ ਮੈਨੂੰ ਆਪਣੇ ਦੋਸਤਾਂ ਜਾਂ ਪਰਿਵਾਰ ਨਾਲ ਮਨੋਰੰਜਨ ਕਰਨਾ ਸਭ ਤੋਂ ਵਧੀਆ ਲੱਗਦਾ ਹੈ ਮੈਂ ਆਪਣੇ ਦੋਸਤਾਂ ਨਾਲ ਕਈ ਬਰਡੇ ਪਾਰਟੀਸ 'ਤੇ ਗਈ ਹਾਂ ਜਦੋਂ ਮੈਂ ਆਪਣੇ ਦੋਸਤਾਂ ਨਾਲ ਕਿਤੇ ਘੁੰਮਣ ਜਾਂਦੀ ਹਾਂ ਤਾਂ ਮੇਰੇ ਮਨ ਨੂੰ ਬਹੁਤ ਹੀ ਰਿਲੈਕਸ ਮਿਲਦਾ ਹੈ ਮੈਨੂੰ ਕੋਈ ਟੈਨਸ਼ਨ ਨਹੀਂ ਰਹਿੰਦੀ ਜੇਕਰ ਮੈਂ ਆਪਣੇ ਪਰਿਵਾਰ ਦੇ ਨਾਲ ਵੀ ਜਾਵਾਂ ਤਾਂ ਸਭ ਅਸੀਂ ਬਹੁਤ ਹੀ ਇੰਜੋਏ ਕਰਦੇ ਹਾਂ ਇਹ ਥੋੜ੍ਹੇ ਪਲ ਦੀ ਖੁਸ਼ੀ ਮੇਰੇ ਮਾਇੰਡ ਨੂੰ ਬਹੁਤ ਹੀ ਰਿਲੈਕਸ ਦਿੰਦੀ ਹੈ ਅਤੇ ਇਹ ਸਾਡੀਆਂ ਯਾਦਾਂ ਬਣ ਜਾਂਦੀਆਂ ਹਨ ਇਸ ਕਰਕੇ ਮੈਨੂੰ ਆਪਣੇ ਪਰਿਵਾਰ ਜਾਂ ਫਿਰ ਦੋਸਤਾਂ ਨਾਲ ਮਿਲਣਾ ਬਹੁਤ ਹੀ ਵਧੀਆ ਲੱਗਦਾ ਹੈ ਇਹ ਛੋਟਾ ਜਿਹਾ ਐਂਟਰਟੇਨਮੈਂਟ ਮੇਰੇ ਲਾਈਫ਼ ਵਿੱਚ ਬਹੁਤ ਇਮਪੋਰਟੈਂਸ ਰੱਖਦਾ ਹੈ ਇਸ ਲਈ ਮੈਂ ਘੁੰਮਣਾ ਆਪਣੇ ਦੋਸਤ ਜਾਂ ਪਰਿਵਾਰ ਨਾਲ ਬਹੁਤ ਪਸੰਦ ਕਰਦੀ ਹਾਂ